ਹਾਂਜੀ ਪੰਜਾਬ ਦੇ ਵਿੱਚ ਕਾਫੀ ਥਾਵਾਂ 'ਤੇ ਘੁੰਮੇ ਹਾਂ ਹਰਿਮੰਦਰ ਸਾਹਿਬ ਖਾਸ ਤੌਰ 'ਤੇ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਜਿਹੜੀਆਂ ਮਤਲਬ ਵੱਡੇ ਸ ਸਿੱਖ ਸੰਸਥਾਨ ਨੇ ਜਿੱਥੇ ਇਤਿਹਾਸਿਕ ਸੰਸਥਾਨ ਨੇ ਅਤੇ ਅੰਮ੍ਰਿਤਸਰ ਦੇ ਵਿੱਚ ਵਿਰਾਸਤੀ ਪਿੰਡ ਹੈਗਾ ਆ ਗੋਬਿੰਦਗੜ੍ਹ ਕਿਲਾ ਹੈਗਾ ਆ ਉੱਥੇ ਘੁੰਮੇ ਹਾਂ ਵਿਰਾਸਤੀ ਪਿੰਡ ਜਿਹੜਾ ਹੈਗਾ ਉੱਥੇ ਪੰਜਾਬ ਦੇ ਮਤਲਬ ਪੁਰਾਣੇ ਕਲਾਸੀਕਲ ਕਲਚਰ ਨੂੰ ਉਹਨਾਂ ਨੇ ਰੀਪ੍ਰਜੈਂਟ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ ਅਤੇ ਹੋਰ ਥਾਵਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ ਵਾਰੀ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਜਿੰਨੇ ਵੀ ਇਤਿਹਾਸਿਕ ਸੰਸਥਾਨ ਨੇ ਇਕੱਲੇ ਸਿੱਖ ਇਤਿਹਾਸ ਨਾਲ ਨਹੀਂ ਹੋਰ ਇਤਿਹਾਸ ਨਾਲ ਸੰਬੰਧਿਤ ਉਹਨਾਂ ਨੂੰ ਵਿਜ਼ਿਟ ਕੀਤਾ ਹੈਗਾ ਆ ਇਸ ਤੋਂ ਇਲਾਵਾ ਪਿੱਛੇ ਜ਼ਿਕਰ ਕੀਤਾ ਸੀਗਾ ਕਿ ਪਟਨਾ ਸਾਹਿਬ ਅਸੀਂ ਫੈਮਲੀ ਸਮੇਤ ਪਿੱਛੇ ਜਾ ਕੇ ਆਏ ਹੈਗੇ ਹਾਂ ਅਤੇ ਅਦਰਵਾਈਜ਼ ਦਸੰਬਰ ਦੀਆਂ ਛੁੱਟੀਆਂ ਕਿਸੇ ਠੰਡੀਆਂ ਥਾਵਾਂ 'ਤੇ ਜਾਈਦਾ ਆ ਅਤੇ ਪਿਛਲੇ ਸਾਲ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੀ ਵਾਈਫ ਦੇ ਨਾਲ ਜਿਹੜਾ ਹੈਗਾ ਆ ਉਹ ਕਸੌਲੀ ਕੁਫਰੀ ਅਤੇ ਨਾਰਕੰਡਾ ਜਿਹੜਾ ਉਹ ਘੁੰਮਣ ਗਿਆ ਸੀ ਅਤੇ ਮੇਰਾ ਬਹੁਤ ਜ਼ਿਆਦਾ ਵਧੀਆ ਤਜ਼ਰਬਾ ਜਿਹੜਾ ਉਹ ਰਿਹਾ ਥੈਂਕ ਯੂ